ਸਤਿ ਸ਼੍ਰੀ ਕਾਲ ਭਾਅ ਜੀ ਹਾਂਜੀ ਹੋਰ ਸੁਣਾਓ ਕਿਵੇਂ ਹੋ ਬਸ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਠੀਕ ਆ ਠੀਕ ਆ ਹੋਰ ਘਰਦੇ ਬਸ ਇੱਧਰ ਵੀ ਸਭ ਵਧੀਆ ਹਾਂਜੀ ਹਾਂਜੀ ਵਧੀਆ ਹੀ ਚਾਹੀਦਾ ਹੋਰ ਹਾਂਜੀ ਉਹ ਭਾਅ ਜੀ ਮੈਂ ਤੁਹਾਨੂੰ ਕਹਿਣਾ ਸੀਗਾ ਕਿ ਤੁਹਾਡੇ ਕੋਲ ਫ਼ੋਨ ਲੈ ਕੇ ਗਏ ਸੀ ਹਾਂਜੀ ਸੈਮਸੰਗ ਗਲੈਕਸੀ ਹਾਂਜੀ ਮੋਡਲ ਜੇ ਸੈਵਨ ਹਾਂਜੀ ਉਹ ਫ਼ੋਨ ਹੈਂਗ ਬੜਾ ਕਰਦਾ ਪਿਆ ਹਾਂਜੀ ਬਹੁਤ ਹੈਂਗ ਕਰਦਾ ਪਿਆ ਉਹ ਉਹਦੇ ਵਿੱਚ ਮਤਲਬ ਉਹਦੀ ਜਿਹੜੀ ਟੱਚ ਆ ਉਹ ਖੁਦ ਕਈ ਵਾਰ ਚੱਲ ਪੈਂਦੀ ਆ ਹਾਂਜੀ ਸਵਿੱਚ ਔਫ ਵੀ ਹੋ ਜਾਂਦਾ ਹਾਂਜੀ ਨਹੀਂ ਪਹਿਲਾਂ ਵੀ ਤੁਹਾਡੇ ਕੋਲ ਫ਼ੋਨ ਖੜੇ ਸੀਗੇ ਹਾਂਜੀ ਨਹੀਂ ਪਹਿਲਾਂ ਫ਼ੋਨ ਖੜੇ ਸੀ ਉਹ ਵਧੀਆ ਸੀ ਬਟ ਜਿਹੜਾ ਹੁਣ ਇਹ ਲੈ ਕੇ ਗਿਆ ਇਹ ਬਹੁਤ ਜ਼ਿਆਦਾ ਮਤਲਬ ਇਹਦੇ ਵਿੱਚ ਪਰੇਸ਼ਾਨੀਆਂ ਆਗੇ ਦੀਆਂ ਹਾਂਜੀ ਨਹੀਂ ਨਹੀਂ ਡਿੱਗਿਆਂ ਤਾਂ ਨਹੀਂ ਪਾਣੀ ਵਿੱਚ ਵੀ ਨਹੀਂ ਪਿਆ ਖੁਦ ਹੀ ਆਪਣੇ ਆਪ ਹੀ ਪਤਾ ਨਹੀਂ ਬੰਦ ਹੋ ਗਿਆ ਸੀ ਔਰ ਉਹ ਤੋਂ ਬਾਅਦ ਇਹਦੀ ਟੱਚ ਵੀ ਹੈਂਗ ਕਰਨ ਲੱਗੀ ਹਾਂਜੀ ਹਾਂਜੀ ਹ ਕਦੇ ਆਵਾਜ਼ ਜ਼ਿਆਦਾ ਹੋ ਜਾਂਦੀ ਆ ਕਦੇ ਬਿਲਕੁਲ ਹੀ ਘੱਟ ਹੋ ਜਾਂਦੀ ਆ ਹਾਂਜੀ ਹ ਨਹੀਂ ਹਾਂ ਬਾ ਕੋਈ ਨਾ ਪਰ ਤੁਸੀਂ ਇੱਕ ਵਾਰ ਚੈੱਕ ਕਰਵਾ ਦਿਓ ਮੈਂ ਤੁਹਾਨੂੰ ਫ਼ੋਨ ਦੇ ਜਾਵਾਂਗੀ ਹਾਂਜੀ ਵੈਸੇ ਹਾਂਜੀ ਸਰਵਿਸ ਸੈਂਟਰ ਤੋਂ ਠੀਕ ਹੋਣਾ ਹਾਂਜੀ ਠੀਕ ਠੀਕ ਬਾਕੀ ਮੈਂ ਤੁਹਾਨੂੰ ਫ਼ੋਨ ਦੇ ਜਾਵਾਂਗੀ ਅਤੇ ਵੈਸੇ ਕਿੰਨੇ ਕੁ ਦਿਨ ਲੱਗਣਗੇ ਠੀਕ ਹੋਣ 'ਚ ਅੱਛਾ ਤਿੰਨ ਚਾਰ ਦਿਨ ਚੱਲੋ ਕੋਈ ਨਾ ਜਦੋਂ ਠੀਕ ਹੋ ਜਾਊਗਾ ਤਾਂ ਤੁਸੀਂ ਮੈਨੂੰ ਇੱਕ ਵਾਰ ਕੌਲ ਕਰ ਦਿਓ ਮੈਂ ਲੈ ਜੂੰਗੀ ਹਾਂਜੀ ਓਕੇ ਥੈਂਕ ਯੂ ਭਾਅ ਜੀ ਓਕੇ